ਖੇਡਾਂ ਸਾਡੇ ਸਰੀਰ ਅਤੇ ਮਾਨਸਿਕ ਤੰਦਰੁਸਤੀ ਵਿੱਚ ਬਹੁਤ ਯੋਗਦਾਨ ਪਾਉਂਦੀਆ ਹਨ ਜਿਵੇਂ ਕਿ ਫੁੱਟਬਾਲ ਫੁੱਟਬਾਲ ਖੇਡਦੇ ਸਮੇਂ ਸਾਡੇ ਸਰੀਰ ਦੀ ਸਾਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ ਜੋ ਉਸ ਵਿੱਚ ਵਿਰੋਧੀ ਟੀਮ ਨੂੰ ਹਰਾਉਣ ਦੇ ਚੱਕਰ ਵਿੱਚ ਬਹੁਤ ਹੀ ਰਨਿੰਗ ਕਰਨੀ ਪੈਂਦੀ ਹੈ ਨੱਠ ਭੱਜ ਕਰਕੇ ਗੋਲ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਕਬੱਡੀ ਆ ਕਬੱਡੀ ਵਿੱਚ ਬਹੁਤ ਹੀ ਜ਼ੋਰ ਲੱਗਦਾ ਹੈ ਤਾਂ ਸਾਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ ਜਿਸ ਨਾਲ ਕਿ ਸਾਡੇ ਸਰੀਰ ਤੰਦਰੁਸਤ ਰਹਿੰਦਾ ਹੈ ਰੋਗਾਂ ਤੋਂ ਮੁਕਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ